ਹੈਲੋ ਸਤਿ ਸ਼੍ਰੀ ਅਕਾਲ ਜੀ ਅਮਨ ਇੰਨਟਿਰਿਅਰ ਡਿਜ਼ਾਇਨਰ ਤੋਂ ਬੋਲਦੇ ਜੀ ਤੁਸੀ ਹਾਂਜੀ ਮੈਂ ਜੀ ਬਠਿੰਡੇ ਤੋਂ ਬੋਲਦਾ ਸੀਗਾ ਜੀ ਮੈਂ ਇੱਕ ਥੋੜ੍ਹਾ ਜਿਹਾ ਤੁਹਾਡੇ ਤੋਂ ਇਨਫੋਰਮੇਸ਼ਨਸ ਲੈਣੀਆਂ ਸੀਗੀਆਂ ਥੋੜ੍ਹੀਆ ਜਿਹੀਆ ਮੈਂ ਨਵਾਂ ਘਰ ਪਾਇਆ ਜੀ ਉਹ ਨਾ ਏਰੀਆ ਹੈਗਾ ਜੀ ਕੋਈ ਸਤਾਰਾਂ ਕੁ ਸੌ ਸਕੇਅਰ ਫੁੱਟ ਦੋ ਕਮਰੇ ਹੈ ਜੀ ਉਹਦੇ ਵਿੱਚ ਅਤੇ ਉਹਨਾਂ ਦੇ ਵਿੱਚ ਮੈਂ ਡਿਜ਼ਾਇਨਿੰਗ ਕਰਵਾਉਣੀ ਆ ਇੰਟੀਰੀਅਰ ਦੀ ਮਤਲਬ ਮੈਂ ਪੀ ਵੀ ਸੀ ਕਰਵਾਉਣੀ ਆ ਜਾਂ ਮੈਂ ਤੁਸੀਂ ਥੋੜਾ ਮੈਨੂੰ ਰਾਏ ਦੇ ਦੋਗੇ ਨਾਲੇ ਤਾਂ ਮੈਨੂੰ ਵੀ ਮੈਂ ਇੱਕ ਤਾਂ ਪੀ ਵੀ ਸੀ ਕਰਵਾਵਾਂ ਜਾਂ ਮੈਂ ਪੀ ਓ ਪੀ ਵਗੈਰਾ ਕਰਵਾਵਾਂ ਥੋੜ੍ਹਾ ਜਿਹਾ ਇਸ ਚੀਜ਼ ਬਾਰੇ ਪੁੱਛਣਾ ਜੀ

ਹਾਂਜੀ ਹਾਂਜੀ ਹਾਂਜੀ ਅੱਛਾ ਜੀ

ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਇਹ ਮੰਨ ਲਓ ਹੁਣ ਆਪਣੀ ਉਹ ਹੈ ਜੀ ਆਪਣੇ ਸਲਾਬ ਜ਼ਿਆਦਾ ਰਹਿੰਦੀ ਆਪਣੇ ਘਰ ਦੇ ਵਿੱਚ ਆਪਣੇ ਏਰੀਆ ਜਿਹੜਾ ਹੈਗਾ ਕਿ ਉਹ ਸਲਾਬ ਦੇ ਵਿੱਚ ਹੈ ਉੱਥੇ ਸਾਨੂੰ ਪੀ ਵੀ ਸੀ ਕਰਵਾਉਣ ਦਾ ਫ਼ਾਇਦਾ ਜਾਂ ਵਾਲਪੇਪਰ ਲਗਵਾਉਣ ਦਾ ਫ਼ਾਇਦਾ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਇਹਦੇ ਵਿੱਚ ਵਾਲਪੇਪਰ ਦੇ ਵਿੱਚ ਮਤਲਬ ਡਿਜ਼ਾਇਨ ਦੇ ਹਿਸਾਬ ਨਾਲ ਜਾਂ ਮਟੀਰੀਅਲ ਦੇ ਹਿਸਾਬ ਨਾਲ ਪੈਸੇ ਦੀ ਕੋਸਟ ਪੈਂਦੀ ਹੈ ਕੀ ਕੋਸਟ ਪਊਗੀ ਜੇ ਤੁਸੀਂ ਮਿਨੀਮਮ ਕੋਸਟ ਲਗਾ ਕੇ ਚਲੋਗੇ ਜੀ ਅਤੇ ਕਮਰਾ ਜੇ ਅੱਛਾ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਸਰ ਥੈਂਕ ਯੂ ਸਰ ਮੈਂ ਤੁਹਾਨੂੰ ਦੱਸਦਾ ਜੀ ਫਿਰ ਠੀਕ ਹੈ